ਪੁਰਾਣਿਆਂ ਸਮਿਆਂ ਵਿੱਚ ਲੋਕ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਹਿਨਦੇ ਸਨ ਜਿਵੇਂ ਕਿ ਕੈਂਠਾ ਪਾਉਂਦੇ ਸੀ ਗਲ਼ ਵਿੱਚ ਤੁਰਲੇ ਵਾਲੀ ਪੱਗ ਬੰਨ੍ਹਦੇ ਸੀ ਪੈਰਾਂ ਵਿੱਚ ਪੰਜਾਬੀ ਜੁੱਤੀ ਪਾਉਂਦੇ ਸੀ ਅਤੇ ਨੀਚੇ ਚਾਦਰਾ ਲਾਉਂਦੇ ਸੀ ਜੋ ਕਿ ਬਹੁਤ ਹੀ ਪ੍ਰਸਿੱਧ ਮੰਨਿਆ ਜਾਂਦਾ ਸੀ ਪੰਜਾਬੀ ਕਲਚਰ ਵਿੱਚ ਇਹ ਜੋ ਕਿ ਸਾਰੇ ਪਹਿਰਾਵੇ ਸਨ ਇਹ ਭੰਗੜੇ ਵਿੱਚ ਯੂਜ਼ ਕਰਦੇ ਸੀ